ਹੈਲੋ ਹਾਂਜੀ ਮੈਂ ਸੀਗਾ ਜੀ ਮੈਂ ਥੋੜੀ ਨਾ ਇਨਫੋਰਮੇਸ਼ਨ ਚਾਹੀਦੀ ਸੀ ਮੈਨੂੰ ਪੰਜਾਬੀ ਸਿਨਮੇ ਬਾਰੇ ਹਾਂਜੀ ਹਾਂਜੀ ਮੈਂ ਕਹਿੰਦਾ ਸੀਗਾ ਕਿ ਪੁਰਾਣੀਆਂ ਪੰਜਾਬੀ ਫਿਲਮਾਂ ਬਣਦੀਆਂ ਸੀਗੀਆਂ ਔਰ ਹੁੰਦੇ ਪੰਜਾਬੀ ਫਿਲਮਾਂ ਬਣਦੀਆਂ ਉਹਦੇ ਵਿੱਚ ਤੁਸੀਂ ਮਤਲਬ ਕਿੰਨਾ ਕੁ ਡਿਫਰੈਂਸ ਆਇਆ ਕਿ ਮਤਲਬ ਪਤਾ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਜੀ ਜੀ ਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਹਾਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ

ਹਾਂਜੀ ਹਾਂਜੀ ਠੀਕ ਹੈ

ਜੀ ਜੀ

ਜਿੰਨੇ ਪੈਸੇ ਖਰਚ ਹੋ ਗਏ ਉਨੀ ਚੀਜ਼ ਉਹਦੇ ਆ ਬਣੂਗੀ ਹੈ ਠੀਕ ਹੈ ਮੈਂ ਭਾਅ ਜੀ ਪੰਜਾਬ ਤੇ ਬੋਲਦਾ ਪਿਆ ਮੈਂ ਇਹ ਨੰਬਰ ਮਿਲਿਆ ਸੀਗਾ ਤੇ ਇਨਫੋਰਮੇਸ਼ਨ ਚਾਹੀਦੀ ਸੀ ਪੰਜਾਬੀ ਸਿਨਮਾ ਬਾਰੇ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਠੀਕ ਹੈ ਚਲੋ ਠੀਕ ਹੈ ਠੀਕ ਹੈ ਭਾਅ ਜੀ ਪਤਾ ਲੱਗ ਗਿਆ ਸਾਰਾ ਕੁਝ ਠੀਕ ਹੈ ਜੀ ਸਤਿ ਸ਼੍ਰੀ ਅਕਾਲ